ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਕਿਆ ਹਾਲ ਚਾਲ ਹੈ ਜੀ ਠੀਕ ਠਾਕ ਹੋ ਜੀ ਭਾਅ ਜੀ ਤੁਹਾਨੂੰ ਪਤਾ ਮੈਂ ਔਰ ਮੇਰੇ ਯਾਰ ਦੋਸਤ ਰੋਜ਼ ਅਸੀਂ ਤੁਹਾਡੇ ਤੋਂ ਭਾਅ ਜੀ ਔਡਰ ਕਰਦੇ ਹਾਂ ਭਾਅ ਜੀ ਨਾਲ਼ ਸੈਲਡ ਹੁੰਦਾ ਜੀ ਦਹੀਂ ਹੁੰਦਾ ਨਾਲ਼ ਤੰਦੂਰੀ ਰੋਟੀ ਹੁੰਦੀ ਹੈ ਜੀ ਕਿਰਪਾ ਕਰਕੇ ਭਾਅ ਜੀ ਤੁਸੀਂ ਭੇਜ ਦਿਓ ਅੱਜ ਵੀ ਅੱਜ ਤੁਸੀਂ ਪੰਜ ਬੰਦਿਆਂ ਦਾ ਖਾਣਾ ਭੇਜ ਦਿਓ ਜੀ ਹਾਂਜੀ ਬਹੁਤ ਲਾਜਵਾਬ ਬਹੁਤ ਵਧੀਆ ਖਾਣਾ ਹੁੰਦਾ ਤੁਹਾਡੇ ਢਾਬੇ ਦਾ ਹਾਂਜੀ ਭਾਅ ਜੀ ਵਧੀਆ ਐਨ ਵਧੀਆ ਹੁੰਦਾ ਜੀ ਕਿਰਪਾ ਕਰਕੇ ਤੁਸੀਂ ਇਹ ਭੇਜ ਦਿਓ ਹਾਂਜੀ ਮੋਹਾਲੀ ਭੇਜ ਦਿਓ ਜੀ ਪੰਜ ਫੇਸ ਹਾਂਜੀ ਹਾਂਜੀ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਭਾਅ ਜੀ ਸ਼ੁਕਰੀਆ